ਸਤਿ ਸ਼੍ਰੀ ਅਕਾਲ ਮੈਂ ਫਲਿੱਪ ਕਾਰਟ ਤੋਂ ਆਪਣੀ ਫੇਅਰਵੈੱਲ ਪਾਰਟੀ ਲਈ ਇੱਕ ਡਰੈਸ ਮੰਗਵਾਈ ਸੀ ਜਿਸ ਦਾ ਉਸ ਵਿੱਚ ਰੰਗ ਗ੍ਰੇਅ ਕਲਰ ਦਾ ਦਿਖਾਈ ਦੇ ਰਿਹਾ ਸੀ ਪਰ ਜਦੋਂ ਔਡਰ ਪਹੁੰਚਿਆ ਤਾਂ ਉਸਦਾ ਰੰਗ ਜਿਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਸੀ ਉਸ ਤੋਂ ਬਹੁਤ ਜ਼ਿਆਦਾ ਵੱਖਰਾ ਸੀ ਪਰ ਹੁਣ ਮੇਰੇ ਕੋਲ ਫੇਅਰਵੈੱਲ ਦੇ ਲਈ ਸਿਰਫ ਦੋ ਦਿਨ ਹੀ ਬਚੇ ਸਨ ਜਿਸ ਕਾਰਨ ਉਸਨੂੰ ਰਿਟਰਨ ਕਰਕੇ ਮੈਂ ਦੁਬਾਰਾ ਨਵਾਂ ਨਹੀਂ ਮੰਗਵਾ ਸਕਦੀ ਸੀ ਫਿਰ ਮੈਨੂੰ ਆਪਣੀ ਫੇਅਰਵੈੱਲ 'ਤੇ ਉਹੀ ਪਾਉਣਾ ਪਿਆ ਨਾ ਚਾਹੁੰਦੇ ਹੋਏ ਵੀ ਤਾਂ ਬਾਅਦ ਵਿੱਚ ਜਦੋਂ ਉਸਨੂੰ ਧੋਤਾ ਗਿਆ ਤਾਂ ਉਸਦਾ ਰੰਗ ਵੀ ਨਿਕਲਿਆ ਕੱਪੜੇ ਦੀ ਕੁਆਲਿਟੀ ਵੀ ਬਹੁਤ ਹਲਕੀ ਸੀ ਜਿਸ ਤਰ੍ਹਾਂ ਦੇ ਜਿੰਨੇ ਪੈਸੇ ਉਸ ਉੱਤੇ ਲਗਾਏ ਗਏ ਸਨ ਉਸ ਤਰ੍ਹਾਂ ਦਾ ਨਾ ਕੱਪੜਾ ਸੀ ਅਤੇ ਨਾ ਰੰਗ ਤਾਂ ਇਸ ਤਰ੍ਹਾਂ ਮੇਰਾ ਫਲਿੱਪਕਾਰਟ ਨਾਲ ਡਰੈਸ ਦੇ ਕੱਪੜਿਆਂ ਦੇ ਮਾਮਲੇ ਵਿੱਚ ਐਕਸਪੀਰੀਅਸ ਵਧੀਆ ਨਹੀਂ ਰਿਹਾ